ਸਾਡੇ ਘਰ ਲਾਗੇ ਬੜਾ ਜ਼ਿਆਦਾ ਕੂੜਾ ਆਉਣ ਲੱਗ ਪਿਆ ਹੈ ਕਿਉਂਕਿ ਹੁਣ ਬਾਹਰ ਦੇ ਲੋਕ ਵੀ ਸਾਡੇ ਘਰ ਲਾਗੇ ਹੀ ਆ ਕੇ ਕੂੜਾ ਸੁੱਟਦੇ ਹਨ ਪਰ ਇਸ ਨੂੰ ਸਾਫ਼ ਕਰਨ ਵਾਸਤੇ ਅ ਅਸੀਂ ਕਾਫੀ ਜ਼ਿਆਦਾ ਉਪਾਅ ਪੈਦਾ ਕੀਤੇ ਹਨ ਇਕ ਉਪਾਅ ਤਾਂ ਹੈ ਕਿ ਆਪਾਂ ਖੁਦ ਹੀ ਹਰ ਸ਼ਨੀਵਾਰ ਅਤੇ ਅ ਵੀਰਵਾਰ ਖੁਦ ਜਾ ਕੇ ਉੱਥੇ ਸਾਫ਼ ਸਫਾਈ ਕਰਨੀ ਹੈ ਅਤੇ ਉਸ ਤੋਂ ਬਾਅਦ 'ਚ ਉਸ ਨੂੰ ਚੱਜ ਨਾਲ ਸਾਫ਼ ਕਰਨਾ ਹੈ ਅਤੇ ਕੁੜੇ ਨੂੰ ਕੂੜੇਦਾਨ ਵਿੱਚ ਪਾਉਣਾ ਹੈ ਅਤੇ ਦੂਜਾ ਉਪਾਅ ਕਿ ਆਪਾਂ ਆਹ ਕੀਤਾ ਹੈ ਕਿ ਆਪਾਂ ਕੂੜੇਦਾਨ ਵਾਲੇ ਭਾਈਆਂ ਨੂੰ ਕਿਹਾ ਹੈ ਕਿ ਇੱਥੇ ਰੋਜ ਆਣ ਕੇ ਕੂੜੇ ਨੂੰ ਚੁੱਕ ਕੇ ਲੈ ਜੇ ਕਰੋ ਤਾਂ ਕਿ ਇੱਥੇ ਗੰਦ ਨਾ ਪਏ ਕੂੜੇ ਕਾਰਨ ਸਿਰਫ ਨਾ ਹੀ ਗੰਦਗੀ ਗੰਦਗੀ ਤਾਂ ਪੈਂਦੀ ਹੀ ਹੈ ਪਰ ਬਿਮਾਰੀਆਂ ਦਾ ਵੀ ਬਹੁਤ ਜ਼ਿਆਦਾ ਖ਼ਤਰਾ ਰਹਿੰਦਾ ਹੈ ਕਿਉਂਕਿ ਅੱਜ ਦੇ ਟਾਈਮ 'ਚ ਵਿੱਚ ਬਿਮਾਰੀਆਂ ਹੀ ਸਭ ਤੋਂ ਵੱਡੀ ਵਜ੍ਹਾ ਹੈ ਲੋਕਾਂ ਦੀ ਜ਼ਿੰਦਗੀ ਲੈਣ ਦਾ ਉੱਤੋਂ ਆਪਾਂ ਇੱਕ ਹੋਰ ਉਪਾਅ ਕੀਤਾ ਹੈ ਕਿ ਜਿਹੜੇ ਜਿਹੜੇ ਲੋਕ ਉੱਥੇ ਕੂੜਾ ਸੁੱਟਦੇ ਹਨ ਆਪਾਂ ਉਨ ਉੱਥੇ ਕੈਮਰਾ ਲਾ ਦਿੱਤਾ ਹੈ ਤਾਂ ਕਿ ਲੋਕਾਂ ਦਾ ਪਤਾ ਚੱਲਦਾ ਰਹੇ ਕਿ ਕਿਹੜੇ ਲੋਕ ਆ ਕੇ ਕੂੜਾ ਸੁੱਟਦੇ ਹਨ ਅਤੇ ਬਾਅਦ ਵਿੱਚ ਆਪਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਕਹਿ ਸਕੀਏ ਕਿ ਇੱਥੇ ਕੂੜਾ ਨਾ ਸੁੱਟੋ ਕਿਉਂਕਿ ਕੂੜਾ ਉਹ ਕੂੜੇ ਵਾਲੀ ਜਗ੍ਹਾ ਨਹੀਂ ਹੈ ਜਿੱਥੇ ਅਗਰ ਇੱਕ ਹੋਰ ਉਪਾਅ ਆਪਾਂ ਇਹ ਵੀ ਕੀਤਾ ਕਿ ਆਪਾਂ ਇੱਕ ਨਵੀਂ ਜਗ੍ਹਾ ਲੱਭ ਰਹੇ ਹਨ ਕੂੜੇ ਵਾਸਤੇ ਤਾਂ ਕਿ ਸਾਰੇ ਲੋਕ ਉੱਥੇ ਕੂੜਾ ਸੁੱਟ ਸਕਣ ਅਤੇ ਸਾਰਾ ਉੱਥੇ ਵਾਤਾਵਰਨ ਸਾਫ਼ ਰਹੇ ਅਤੇ ਕੂੜੇ ਪਰ ਇਹ ਸਭ ਤੋਂ ਵੱਡੀ ਗੱਲ ਆਹ ਹੈ ਕਿ ਲੋਕਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਕਿਉਂਕਿ ਕੁਛ ਲੋਕ ਇੱਦਾਂ ਦੇ ਹਨ ਜਿਹੜੇ ਕਹਿੰਦੇ ਹਨ ਕਿ ਦੂਸਰੀ ਜਗ੍ਹਾ ਸਾਡੇ ਤੋਂ ਦੂਰ ਪੈਂਦੀ ਹਨ ਅਤੇ ਇਹ ਜਗ੍ਹਾ ਲਾਗੇ ਹਨ ਪਰ ਹੁਣ ਉਹ ਇਹ ਨਹੀਂ ਸਮਝਦੇ ਕਿ ਇਹ ਸਾਡੇ ਘਰ ਦੇ ਲਾਗੇ ਹਨ ਅਤੇ ਕੂੜਾ ਇਹ ਸੁੱਟਣਾ ਇੱਥੇ ਸਾਡੇ ਵਾਸਤੇ ਕਾਫੀ ਬੁਰੀ ਗੱਲ ਹੈ ਅਤੇ ਆਪਾਂ ਬਸ ਇਹ ਹੀ ਟਰਾਏ ਕਰਦੇ ਰਹਿੰਦੇ ਹਨ ਕਿ ਲੋਕਾਂ ਨੂੰ ਸਮਝਾਈਏ ਕਿ ਇੱਥੇ ਕੂੜਾ ਨਾ ਸੁਟੋ ਤਾਂ ਕਿ ਆਪਾਂ ਫਿਰ ਅੱਗੇ ਵਧਦੇ ਰਹੀਏ ਅਤੇ ਕੂੜੇ ਜਗ੍ਹਾ ਨੂੰ ਸਾਫ਼ ਰੱਖੀਏ ਅਤੇ ਆਪਾਂ ਬਸ ਕੂੜੇਦਾਨ ਵਾਲੇ ਭਾਈਆਂ ਨੂੰ ਵੀ ਕਹਿ ਦਿੱਤਾ ਹੈ ਕਿ ਰੋਜ਼ ਆ ਕੇ ਇੱਥੇ ਕੂੜਾ ਸੁਟੋ ਇਹ ਚੁੱਕੋ ਤਾਂ ਕਿ ਸਾਡੇ ਘਰ ਦੇ ਲਾਗੇ ਜਗ੍ਹਾ ਸਾਫ਼ ਰਹੇ ਅਤੇ ਆਪਾਂ ਰੋਜ਼ ਇੱਥੇ ਸੁੱਖ ਦਾ ਸਾਹ ਲੈ ਸਕੀਏ